ਹਾਂ ਜੇਕਰ ਅਸੀਂ ਬਾਗਬਾਨੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਗਾਰਡਨਿੰਗ ਦੇ ਵਿੱਚ ਜਿਹੜਾ ਮੌਸਮ ਹੈ ਜਿਵੇਂ ਬਦਲਦਾ ਰਹਿੰਦਾ ਉਸ ਤਰੀਕੇ ਦੇ ਨਾਲ ਸਾਨੂੰ ਜਿਹੜੇ ਸਾਡੇ ਕੰਮ ਕਰਨੇ ਰੂਟੀਨ ਨੇ ਦੇਖਭਾਲ ਦੇ ਲਈ ਹੋ ਗਿਆ ਕਿਹੜੀ ਅਸੀਂ ਫਲ ਜਾਂ ਕਿਹੜੇ ਬੂਟੇ ਕਿਹੜੀਆਂ ਸਬਜ਼ੀਆਂ ਉਹਦੇ ਵਿੱਚ ਉਗਾਣੀਆਂ ਨੇ ਉਹ ਸਾਰਾ ਕੁਛ ਉਸ ਜਿਹੜੇ ਐਗਾ ਤਰੀਕੇ ਦੇ ਨਾਲ ਚੁਣਨਾ ਪੈਂਦਾ ਐਗਾ ਇਹਦੇ ਲਈ ਜਿਹੜਾ ਸਾਨੂੰ ਨਿਰੰਤਰ ਕਾਰਜ ਨੇ ਉਹ ਕਰਨੇ ਪੈਂਦੇ ਨੇਗੇ ਜੇਕਰ ਅਸੀਂ ਇਹ ਗੱਲ ਕਰੀਏ ਕਿ ਅਸੀਂ ਅੱਜ ਜਿਹੜੇ ਹੈਗੇ ਬੀਜ ਬੀਜਤੇ ਤਾਂ ਉਹਦੀ ਅਸੀਂ ਦੇਖਭਾਲ ਨਾ ਕਰੀਏ ਤਾਂ ਉਹ ਜਿਹੜਾ ਪੌਦਾ ਉਹ ਮੁਰਝਾ ਜਾਊਗਾ ਇਸ ਲਈ ਸਾਨੂੰ ਨਿਰੰਤਰ ਉਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਐਗਾ ਕੰਮ ਕਰਨਾ ਪੈਂਦਾ ਬੀਜ ਬੀਜਣ ਤੋਂ ਲੈ ਕੇ ਪ ਪੌਦੇ ਦੇ ਉੱਗਣ ਤੋਂ ਬਾਅਦ ਉਹਦੇ ਆਸੇ ਪਾਸੇ ਅਸੀਂ ਦੇਖਦੇ ਹਾਂ ਕਿ ਕੋਈ ਨਦੀਨ ਤਾਂ ਨਹੀਂ ਹੈ ਜੇਕਰ ਨਦੀਨ ਹੈਗੇ ਆ ਤਾਂ ਉਹਨਾਂ ਦਾ ਖਾਤਮਾ ਕਿਵੇਂ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਉਸ ਪੌਦੇ ਨੂੰ ਕੋਈ ਬਿਮਾਰੀ ਨਾ ਲੱਗੇ ਉਹਨਾਂ ਨੂੰ ਰੋਗਾਂ ਤੋਂ ਬਚਾਉਣਾ ਜਿਹੜਾ ਇਹਦੇ ਲਈ ਵੀ ਸਾਨੂੰ ਨਿਰੰਤਰ ਉਹਦੀ ਦੇਖਭਾਲ ਕਰਨੀ ਪੈਂਦੀ ਹੈ ਇਹਦੇ ਲਈ ਅਸੀਂ ਜਿਹੜੇ ਖੇਤੀ ਮਾਹਰ ਨੇ ਉਹਨਾਂ ਦੀ ਸਲਾਹ ਲੈ ਸਕਦੇ ਹਾਂ ਇਸ ਤੋਂ ਇਲਾਵਾ ਪੀ ਏ ਯੂ ਦੀ ਜਿਹੜੀ ਆਉਂਦੀ ਹੈਗੀ ਗਾਰਡਨਿੰਗ ਦੇ ਲਈ ਸਾਡੇ ਕੋਲ ਗਾਈਡਲਾਈਨ ਪੁਸਤਕਾਂ ਆਉਂਦੀਆਂ ਨੇ ਅਸੀਂ ਉਹ ਦੇਖ ਸਕਦੇ ਹੈਗੇ ਜਾਂ ਸਾਡੇ ਕੋਲ ਅੱਜ ਕੱਲ੍ਹ ਇੰਟਰਨੈਟ ਜਿਹੜਾ ਇੱਕ ਮੁੱਖ ਸਰੋਤ ਹੈਗਾ ਉਹਦੇ ਉੱਪਰ ਅਸੀਂ ਇਸ ਚੀਜ਼ ਬਾਰੇ ਦੇਖ ਸਕਦੇ ਹਾਂ ਸੁਣ ਸਕਦੇ ਹਾਂ ਅਤੇ ਆਪਣੀ ਬਾਗਬਾਨੀ ਨੂੰ ਹੋਰ ਜ਼ਿਆਦਾ ਵਧੀਆ ਬਣਾ ਸਕਦੇ ਹਾਂ